ਹਾਂਜ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਹੋਰ ਕਿਵੇਂ ਹੋ ਸਭ

ਇਹ ਤੁਸੀਂ ਸਾਹਿਬ ਢਾਬਾ ਤੋਂ ਬਿਲੋ ਬੋਲਦੇ ਹੋ ਹਾਂਜੀ ਮੇਰੀ ਦੋ ਮੇਰੇ ਦੋਸਤ ਨੇ ਮੈਨੂੰ ਦੱਸਿਆ ਸੀ ਕਿ ਸਾਹਿਬ ਢਾਬੇ ਦਾ ਮਤਲਬ ਕਿ ਜੋ ਵੀ ਸਮੱਗਰੀ ਬਣਦੀ ਆ ਉੱਥੇ ਕਿ ਬਹੁਤ ਵਧੀਆ ਬਣਦੀ ਆ ਅਤੇ ਉਹਦੇ ਕਹਿਣ 'ਤੇ ਹੀ ਮੈਂ ਤੁਹਾਡੀ ਸਮੱਗਰੀ ਮੰਗਾਈ ਆ ਖਾਣ ਵਾਸਤੇ ਮੈਂ ਪੰਜ ਆਈਟ ਆਈਟਮਾਂ ਪਨੀਰ ਰ ਡਰਿੰਕ ਪਨੀਰ ਡਰਿੰਕ ਪਕੌੜੇ ਸਮੋਸੇ ਅਤੇ ਪੀਜ਼ਾ ਇਹ ਮੰਗਾਇਆ ਸੀ ਅਤੇ ਉਹ ਆਈ ਆਈਟਮਾਂ ਦੇਖਣ ਵਿੱਚ ਮੇਰੇ ਤੱਕ ਆਈਆਂ ਅਤੇ ਜਦੋਂ ਆਈਆਂ ਉਹਨਾਂ ਦਾ ਮਿਕਸ ਅੱਪ ਹੋਇਆ ਹੋਇਆ ਸੀਗਾ ਜਿਸ ਕਰਕੇ ਉਹ ਸਾਰੇ ਮਿਕਸ ਸੀਗੇ ਅਤੇ ਮੈਂ ਵਾਪ ਇਹ ਇਹ ਚੀਜ਼ ਮਤਲਬ ਵਾਪਸ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਪ੍ਰਸੈਸ ਦੱਸੋ ਕਿ ਇਹ ਪੋਸੀਬਲ ਹੈ ਮੈਂ ਵਾਪਸ ਕਰ ਸਕਦੀ ਹਾਂ ਅਤੇ ਜੇ ਕਰ ਸਕਦੀ ਹਾਂ ਤਾਂ ਕਿਵੇਂ ਕਰ ਸਕਦੀ ਹਾਂ ਪੋਸੀਬਲ ਹੈ ਜਾਂ ਨਹੀਂ